ਗਾਉਣਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਗਾਉਣ ਦੀਆਂ ਬਹੁਤ ਸਾਰੀਆਂ ਸੈਲੀਆਂ ਹੁੰਦੀਆਂ ਹਨ ਜਿਵੇਂ ਕਿ ਕੁਝ ਇਸ ਪ੍ਰਕਾਰ ਹਨ ਕਿ ਹਿੰਦੁਸਤਾਨੀ ਕਲਾਸੀਕਲ ਕਰਨਾਟਕ ਕਲਾਸੀਕਲ ਪੰਜਾਬੀ ਫੋਕ ਤੇ ਰਾਜਸਥਾਨੀ ਫੋਕ ਅਲੱਗ ਅਲੱਗ ਕਹਿ ਲਓ ਅਲੱਗ ਅਲੱਗ ਥਾਵਾਂ ਦੇ ਅਲੱਗ ਅਲੱਗ ਫੋਕ ਹੁੰਦੇ ਨੇ ਤੇ ਬੋਲੀਵੁੱਡ ਸਟਾਈਲ ਹੋ ਗਿਆ ਵੈਸਟਰਨ ਸਟਾਈਲ ਹੋ ਗਿਆ ਗਜ਼ਲਾਂ ਹੋ ਗਈਆਂ ਸੋਫਟ ਗਾਣੇ ਹੋ ਗਏ ਤੇ ਇਹਨਾਂ ਸ਼ੈਲੀਆਂ ਵਿੱਚੋਂ ਮੈਨੂੰ ਇੱਕ ਹਿੰਦੁਸਤਾਨੀ ਕਲਾਸੀਕਲ ਪਸੰਦ ਹ ਵੈਸੇ ਤੇ ਹਰ ਸ਼ੈਲੀ ਦਾ ਆਪਣਾ ਆਪਣਾ ਪ੍ਰਭਾਵ ਹੁੰਦਾ ਹੈ ਪਰ ਮੈਨੂੰ ਹਿੰਦੁਸਤਾਨੀ ਹਿੰਦੁਸਤਾਨੀ ਕਲਾਸੀਕਲ ਅਤੇ ਬੋਲੀਵੁੱਡ ਸੋਫਟ ਸਟਾਈਲ ਗਜ਼ਲਜ਼ ਗਜ਼ਲਾਂ ਯੇਹ ਸਭ ਇਹ ਸ਼ੈਲੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਹਨ ਕਿਉਂਕਿ ਇਨਾਂ ਵਿਚ ਜਿਹੜਾ ਗਾਇਕ ਹੁੰਦਾ ਹੈ ਉਹ ਸੁਰਾਂ ਨਾਲ ਖੇਡਦਾ ਹੈ ਜਿਵੇਂ ਫੋਕ ਵਿੱਚ ਖੜਵੇਂ ਸੁਰ ਹੁੰਦੇ ਹਨ ਪਰ ਕਲਾਸਿਕਲ ਵਿੱਚ ਅਤੇ ਇਹਨਾਂ ਸੋਫਟ ਸੈਲੀਆਂ ਵਿੱਚ ਬੋਲੀਵੁੱਡ ਸ਼ੈਲੀਆਂ ਵਿੱਚ ਤੇ ਗਜ਼ਲਾਂ ਵਿੱਚ ਇਹਨਾਂ ਵਿੱਚ ਸੁਰਾਂ ਨਾਲ ਖੇਡਿਆ ਜਾਂਦਾ ਹੈ ਤੇ ਉਹ ਚੀਜ਼ ਮੈਨੂੰ ਬਹੁਤ ਅੱਛੀ ਲੱਗਦੀ ਹੈ ਉਹ ਚੀਜ਼ ਮੈਨੂੰ ਮੋਹਦੀ ਹੈ ਅਤੇ ਮੈਨ ਮੈਂ ਵੀ ਇਹ ਸੈਲੀਆਂ ਗਾਨਾ ਵਾ ਮੈਨੂੰ ਗਾਣੀਆਂ ਪਸੰਦ ਨੇ ਸ਼ੈਲੀਆਂ ਜਿਵੇਂ ਬੋਲੀਵੁੱਡ ਚ ਆ ਜਾਂਦੇ ਨੇ ਮੁਹੰਮਦ ਰਫੀ ਸਾਹਿਬ ਕਿਸ਼ੋਰ ਕੁਮਾਰ ਸਾਹਿਬ ਆ ਜਾਂਦੇ ਨੇ ਹਿੰਦੁਸਤਾਨੀ ਕਲਾਸੀਕਲ ਦੇ ਹਿੰਦੁਸਤਾਨੀ ਕਲਾਸੀਕਲ ਚ ਆ ਜਾਂਦੇ ਅਜੇ ਚੱਕਰਵਰਤੀ ਜੀ ਅਤੇ ਦੇਵ ਪ੍ਰਿਆਧਿਕਾਰੀ ਜੀ ਗਿਰਿਜਾ ਦੇਵੀ ਜੀ ਗਜ਼ਲਾਂ ਵਿੱਚ ਨਾਮ ਹਨ ਗੁਲਾਮ ਅਲੀ ਸਾਹਿਬ ਜਗਜੀਤ ਸਿੰਘ ਅਤੇ ਆਦ ਮੈਂ ਇਹਨਾਂ ਨੂੰ ਸੁਣਦਾ ਹਾਂ ਤੇ ਦੇਖਦਾ ਹਾਂ ਕਿ ਉਹ ਕਿਵੇਂ ਸੁਰਾਂ ਨਾਲ ਖੇਡਦੇ ਹਨ ਹਰ ਗਜ਼ਲ ਵਿੱਚ ਹਰ ਹਿੰਦੁਸਤਾਨੀ ਕਲਾਸੀਕਲ ਦੀ ਜਿਹੜੀਆਂ ਵੀ ਬੰਦਿਸ਼ਾਂ ਹੁੰਦੀਆਂ ਹਨ ਠੁੰਬਰੀਆਂ ਹੁੰਦੀਆਂ ਹਨ ਇਹਨਾਂ ਵਿੱਚ ਸੰਗੀਤ ਦਾ ਅਲੱਗ ਹੀ ਅੰਦਾਜ਼ ਦਿਖਾਇਆ ਜਾਂਦਾ ਹੈ ਜੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਤਾਂ ਮੈਨੂੰ ਇਹ ਸ਼ੈਲੀ ਬਹੁਤ ਅੱਛੀ ਲੱਗਦੀ ਹੈ ਇਹ ਗਾਇਨ ਸ਼ੈਲੀ